ਮੋਟਰਸਾਈਕਲ ਸਕੂਟਰ ਸਾਈਕਲ ਸਕੂਟੀ ਟਾਂਗਾ ਰਿਕਸ਼ਾ ਇਲੈਕਟ੍ਰਿਕ ਸਕੂਟਰ ਕਾਰ ਜੀਪ ਐਸ ਯੂ ਵੀ ਸੈਡਾਨ ਹੈਚਬੈਕ ਕਬੱਡੀ ਵੱਲ ਲਿੰਬੋਜੀਨ ਵੈਨ ਟਰੱਕ ਬੱਸ ਮਿੰਨੀ ਬੱਸ ਟੈਂਪੋ ਟਰੈਕਟਰ ਟਰਾਲਾ ਕੈਂਟਰ ਬੁਲਡੋਜ਼ਰ ਕਰੇਨ ਮਿਕਸਰ ਟਰੱਕ ਰੇਲ ਗੱਡੀ ਮੈਟਰੋ ਇੰਜਨ ਵੈਂਗਨ ਟਰੰਮ ਹਵਾਈ ਜਹਾਜ ਹੈਲੀਕਾਪਟਰ ਗਲਾਈਡਰ ਡਰੋਨ ਪੈਸੰਜਰ ਜਹਾਜ ਨੋਕਾ ਜਹਾਜ ਸਾਈਮਰ ਪਤੰਗੀ ਨੋਕਾ ਸਮਰੀਨ ਥੈਂਕ ਯੂ ਧੰਨਵਾਦ